ਹਾਂਜੀ ਆਪਣੇ ਸਕੂਲਾਂ ਦੇ ਵਿੱਚ ਹੈਨਾ ਅਲੱਗ ਅਲੱਗ ਤਰ੍ਹਾਂ ਦਾ ਸਿਲੇਬਸ ਹੁੰਦਾ ਹੈਗਾ ਅਤੇ ਪਰ ਜੇ ਸਿਲੇਬਸ ਦੀ ਗੱਲ ਕੀਤੀ ਜਾਵੇ ਜਿਵੇਂ ਜਿਵੇਂ ਮੰਨ ਲਓ ਹੁਣ ਮੋਡਰਨ ਟਾਈਮ ਚੱਲ ਰਿਹਾ ਹੈਗਾ ਅਤੇ ਮੈਂ ਇਹ ਸਮਝਦਾ ਹੈਗਾ ਵੀ ਬੱਚਿਆਂ ਨੂੰ ਫਾਇਨਾਂਸ ਬਾਰੇ ਲੋਨ ਬਾਰੇ ਜਾਂ ਆਈ ਟੀ ਰਿਟਰਨ ਹੁੰਦੀ ਇਨਕਮ ਟੈਕਸ ਰਿਟਰਨ ਹੈਗੀਆਂ ਨੇ ਇਨ੍ਹਾਂ ਬਾਰੇ ਵੀ ਥੋੜ੍ਹੀ ਬਹੁਤੀ ਬੇਸਕ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਣਾ ਜੋ ਫਾਇਨਾਂਸ ਆ ਜਾਂ ਜੋ ਫੰਡਸ ਹੈਗੇ ਨੇ ਜਾਂ ਕੈਸ਼ ਹੈਗਾ ਉਹਨੂੰ ਕਿੱਦਾਂ ਮੈਨੇਜ ਕਰਨਾ ਹੈਗਾ ਕਿੱਦਾਂ ਰੇਟ ਓਫ ਇੰਟ੍ਰਸਟ ਕੈਲਕੂਲੇਟ ਹੁੰਦਾ ਕਿੱਦਾਂ ਰਿਟਰਨ ਭਰੀ ਜਾਂਦੀ ਹੈ ਕਿੱਦਾਂ ਜੋ ਹੁੰਦਾ ਹੈਗਾ ਆਪਣਾ ਜੋ ਇਨਕਮ ਟੈਕਸ ਹੁੰਦਾ ਹੈਗਾ ਕੈਲਕੂਲੇਟ ਕੀਤਾ ਜਾਂਦਾ ਹੈਨਾ ਬੱਚਿਆਂ ਨੂੰ ਜੋ ਆਈ ਟੀ ਆਰ ਹੁੰਦੀ ਹੈਗੀ ਉਹਦੀ ਅਪੋਟੈਂਸ ਪਤਾ ਹੋਣੀ ਚਾਹੀਦੀ ਹੈਗੀ ਅਤੇ ਜੋ ਲੋਨ ਹੁੰਦਾ ਹੈਗਾ ਕਿੰਨੇ ਟਾਈਮ ਪੀਰੀਅਡ ਦਾ ਹੁੰਦਾ ਹੈਗਾ ਕਿੱਦਾਂ ਉਹ 'ਤੇ ਰੇਟ ਓਫ ਇੰਟਰਸਟਡ ਇੰਰਸਟ ਲੱਗਦਾ ਹੈਗਾ ਅਤੇ ਕਿਵੇਂ ਲੋਨ ਜਿਹੜਾ ਹੈਗਾ ਦਿੱਤਾ ਜਾਂਦਾ ਲਿਆ ਜਾਂਦਾ ਉਹਦੇ ਕੀ ਕੀ ਉਹ ਵੀਕ ਪੋਇੰਟਸ ਹੁੰਦੇ ਨੇ ਕੁਛ ਉਹਦੇ 'ਚ ਹੈਨਾ ਪੋਲਸੀਜ ਹੁੰਦੀਆਂ ਨੇ ਟਰਮਸ ਕੰਡੀਸ਼ਨਸ ਹੁੰਦੀਆਂ ਨੇ ਇਨ੍ਹਾਂ ਸਾਰਿਆਂ ਬਾਰੇ ਥੋੜ੍ਹਾ ਥੋੜ੍ਹਾ ਸਿਲੇਬਸ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਐਗਾ ਹੈਨਾ ਅਤੇ ਇਹਦੇ ਨਾਲ ਜੋ ਬੱਚੇ ਹੈਗੇ ਨੇ ਅਤੇ ਆਪਣੇ ਪੇਰੈਂਟਸ ਨੂੰ ਜਾਂ ਆਪਣਾ ਜੋ ਫਿਊਚਰ ਹੈ ਉਹਦੇ ਵਿੱਚ ਜਿੱਥੇ ਕਿਤੇ ਵੀ ਕੰਮ ਕਰਨਗੇ ਹੈਨਾ ਅਤੇ ਉਨ੍ਹਾਂ ਲਈ ਇਹ ਚੀਜ਼ ਬਹੁਤ ਹੈਲਪਫੁੱਲ ਹੋਊਗੀ

ਜੋ ਸਿਲੇਬਸ ਹੈ ਹੈਨਾ ਇਹਦੇ ਪੈਟਰਨ ਦੇ ਵਿੱਚ ਇਹ ਚੀਜ਼ਾਂ ਜੋ ਫਾਇਨਾਂਸ ਨੂੰ ਲੈ ਕੇ ਟੈਕਸ ਨੂੰ ਲੈ ਕੇ ਆਈ ਟੀ ਆਰ ਰਿਟਰਨ ਨੂੰ ਲੈ ਕੇ ਹੋਣੀਆਂ ਬਹੁਤ ਜ਼ਰੂਰੀ ਆ ਅਤੇ ਜੇ ਕੋਈ ਟੈਕਸ ਭਰਦਾ ਹੈਗਾ ਸ਼ ਭਾਵੇਂ ਉਹ ਆਈ ਟੀ ਆਰ ਖਾਲੀ ਮਤਲਬ ਬਿਲਕੁਲ ਜੀਰੋ ਰਿਟਰਨ ਵੀ ਭਰਦਾ ਉਹਦੇ ਨਾਲ ਵੀ ਮਤਲਬ ਜੋ ਸਿੱਬਲ ਸਕੋਰ ਹੁੰਦਾ ਹੈਗਾ ਉਹ ਵਧਦਾ ਉਹਦੇ ਨਾਲ ਜੇ ਕੋਈ ਕਿਸੇ ਨੇ ਵੀ ਅੱਗੇ ਤੋਂ ਲੋਨ ਲੈਣਾ ਹੈਗਾ ਤਾਂ ਉਹ ਲੋਨ ਲੈਣ ਦੇ ਵਿੱਚ ਉਹ ਹੈਲਪਫੁੱਲ ਹੁੰਦੀ ਉਹ ਚੀਜ਼ ਕਾਫੀ ਅਤੇ ਇਸ ਕਰਕੇ ਜੋ ਬੱਚੇ ਹੈਗੇ ਨੇ ਬੱਚਿਆਂ ਦੇ ਸਿਲੇਬਸ ਦੇ ਵਿੱਚ ਮੇਰੇ ਹਿਸਾਬ ਨਾਲ ਇਹ ਚੀਜ਼ ਬਹੁਤ ਜ਼ਰੂਰੀ ਹੈਗੀ ਉਨ੍ਹਾਂ ਨੂੰ ਮੈਥ ਦੇ ਨਾਲ ਨਾਲ ਜੋ ਐਕਚੂਅਲ ਦੇ ਵਿੱਚ ਜੋ ਗਰਾਉਂਡ ਲੈਵਲ 'ਤੇ ਜੋ ਚੀਜ਼ਾਂ ਚੱਲ ਰਹੀਆਂ ਨੇ ਉਨ੍ਹਾਂ ਬਾਰੇ ਪਤਾ ਹੋਣਾ ਚਾਹੀਦਾ ਥੋੜ੍ਹਾ ਥੋੜ੍ਹਾ ਬੈਂਕਿੰਗ ਦਾ ਪਤਾ ਹੋਣਾ ਚਾਹੀਦਾ ਕਿਉਂਕਿ ਜਿਵੇਂ ਆ ਜਿਹੜਾ ਹੁਣ ਦਾ ਟਾਈਮ ਹੈਗਾ ਬਹੁਤ ਜ਼ਿਆਦਾ ਉਹ ਆਈ ਟੀ ਆਈ ਟੀ ਵਾਲਾ ਕੰਮ ਚੱਲ ਰਿਹਾ ਹੈਗਾ ਅਤੇ ਬੱਚਿਆਂ ਨੂੰ ਸੋਫਟਵੇਅਰਾਂ ਬਾਰੇ ਜਾਂ ਕੁਛ ਮੈਨੂਅਲ ਜੋ ਕੰਮ ਹੈਗੇ ਨੇ ਉਨ੍ਹਾਂ ਬਾਰੇ ਪਤਾ ਹੋਣਾ ਚਾਹੀਦਾ ਵੀ ਰੇਟ ਓਫ ਇੰਟ੍ਰਸਟ ਕਿੱਦਾਂ ਲੱਗਦਾ ਇੰਟ੍ਰਸਟ ਕੈਲਕੂਲੇਟ ਕਰਨ ਦੇ ਇੰਟ੍ਰਸਟ ਲਾਉਣ ਦੇ ਜਾਂ ਕੈਲਕੂਲੇਟ ਕਰਨ ਦੇ ਅਲੱਗ ਅਲੱਗ ਤਰੀਕੇ ਹੁੰਦੇ ਨੇ ਕਿਸ਼ਤ ਇੰਸਟੋਲਮੈਂਟ ਕਿੱਦਾਂ ਬਣਾਈ ਜਾਂਦੀ ਹੈ ਹੈਨਾ ਅਤੇ ਉਹ ਨੋਰਮਲੀ ਪਤਾ ਹੋਣਾ ਚਾਹੀਦਾ ਵੀ ਜੋ ਵੀ ਅੱਗੇ ਤੋਂ ਕੋਈ ਲੋਨ ਲੈਂਦਾ ਤਾਂ ਉਹ ਘੱਟੋਂ ਘੱਟ ਅਵੇਅਰ ਰਹੇ ਜਾਗਰੂਕ ਰਹੇ ਵੀ ਉਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਹਿ ਲਓ ਫਰੋਡ ਜਾਂ ਕਹਿ ਲਓ ਕਿਸੇ ਵੀ ਤਰ੍ਹਾਂ ਦਾ ਧੱਕਾ ਨਾ ਹੋਵੇ ਚੀਜ਼ਾਂ ਬਹੁਤ ਜ਼ਰੂਰੀ ਨੇ ਥੈਂਕਿ ਊ